ਟੈਲੀਵਿਜ਼ਨ 'ਤੇ ਮੇਰਾ ਮਨਪਸੰਦ ਸ਼ੋ ਐਮ ਟੀ ਵੀ ਚੈਨਲ 'ਤੇ ਐਮ ਟੀ ਵੀ ਹਸਲ ਹੈ ਇਸ ਵਿੱਚ ਨਵੇਂ ਨਵੇਂ ਗਾਇਕ ਆਉਂਦੇ ਨੇ ਅਤੇ ਆਪਣੇ ਲਿਖੇ ਆਪ ਗਾਣੇ ਗਾਉਂਦੇ ਨੇ ਇਹ ਬਹੁਤ ਹੀ ਵਧੀਆ ਸ਼ੋ ਹੈ ਇਸ ਕਰਕੇ ਇਹਨੂੰ ਵੇਖ ਵੇਖ ਕੇ ਮੈਂ ਅਤੇ ਮੇਰਾ ਭਰਾ ਬਹੁਤ ਜ਼ਿਆਦਾ ਪ੍ਰਭਾ ਪ੍ਰਭਾਵਿਤ ਹੋਏ ਹਨ ਮੇਰੇ ਭਰਾ ਨੇ ਤਾਂ ਆਪਣੇ ਗਾਣੇ ਅਤੇ ਆਪਣਾ ਖੁਦ ਦਾ ਮਿਊਜਿਕ ਬਣਾਉਣਾ ਵੀ ਸ਼ੁਰੂ ਕਰਤਾ ਹੈ ਇਸ 'ਤੇ ਨਵੇਂ ਨਵੇਂ ਇਸ ਦਾ ਪਹਿਲਾਂ ਜਿਹੜਾ ਸੀਜ਼ਨ ਆਇਆ ਸੀ ਉਹ ਦੋ ਹਜ਼ਾਰ ਉੱਨੀ 'ਚ ਆਇਆ ਸੀ ਜਿਸ ਦਾ ਵਿਜੇਤਾ ਐਮ ਸੀ ਬੈਲਾ ਰਿਹਾ ਸੀ ਦੂਜੇ ਨੰਬਰ 'ਤੇ ਈ ਪੀ ਆਰ ਅਤੇ ਤੀਜੇ ਨੰਬਰ 'ਤੇ ਕਿੰਗ ਆਇਆ ਸੀ ਕਿੰਗ ਮੇਰਾ ਬਹੁਤ ਹੀ ਫੇਵਰੇਟ ਹੈ ਬਹੁਤ ਹੀ ਮੈਨੂੰ ਜ਼ਿਆਦਾ ਪਸੰਦ ਹੈ ਹਰ ਰੋਜ਼ ਉਹਦੇ ਗਾਣੇ ਸੁਣਦਾ ਹਾਂ ਸਵੇਰੇ ਸ਼ਾਮੀ ਜਦੋਂ ਮੈਨੂੰ ਟਾਈਮ ਮਿਲੇ ਅਤੇ ਇਸ ਦਾ ਜਿਹੜਾ ਸੀਜ਼ਨ ਟੂ ਆਇਆ ਸੀ ਉਹ ਆਇਆ ਸੀ ਦੋ ਹਜ਼ਾਰ ਬਾਈ ਵਿੱਚ ਜਿਸਦਾ ਵਿਜੇਤਾ ਰਿਹਾ ਸੀ ਐਮ ਸੀ ਸਕੇਅਰ ਅਤੇ ਦੂਜੇ ਨੰਬਰ 'ਤੇ ਪੈਰਾਡੋਕਸ ਆਇਆ ਸੀ ਅਤੇ ਉਸ ਸੀਜ਼ਨ ਦਾ ਮੇਰਾ ਸਭ ਤੋਂ ਮਨਪਸੰਦ ਬੰਦਾ ਪੈਰਾਡੋਕਸ ਸੀ ਸੀ ਉਹ ਅਜੇ ਉੱਨੀ ਸਾਲ ਦਾ ਹੈ ਅਤੇ ਉਸਨੇ ਇਸ ਟਾਈਮ ਬਹੁਤ ਹੀ ਜ਼ਿਆਦਾ ਚੜ੍ਹਾਈ ਕਰ ਲਈ ਹੈ ਅਤੇ ਇਸ ਦਾ ਤੀਜਾ ਸੀਜ਼ਨ ਦੋ ਹਜ਼ਾਰ ਬਾਈ ਪਿਛਲੇ ਸਾਲ ਹੀ ਆਇਆ ਹੈ ਅਤੇ ਮੇਰਾ ਉਸ ਵਿੱਚ ਮਨਪਸੰਦੀਦਾ ਸਭ ਤੋਂ ਜ਼ਿਆਦਾ ਸੀ ਉਦੈ ਅਤੇ ਬੇਸਿਕ ਉਦੈ ਪਹਿਲੇ ਨੰਬਰ 'ਤੇ ਅਤੇ ਬੇਸਿਕ ਦੂਜੇ ਨੰਬਰ 'ਤੇ ਆਇਆ ਸੀ ਵੈਸੇ ਦੇਖਿਆ ਜਾਵੇ ਤਾਂ ਦੂਜੇ ਅਤੇ ਤੀਜੇ ਸੀਜ਼ਨ ਵਿੱਚ ਇੱਕ ਚੀਜ਼ ਬਹੁਤ ਹੀ ਜ਼ਿਆਦਾ ਇੱਕੋ ਜਿਹੀ ਹੋਈ ਹੈ ਜਿਸ ਵਿੱਚ ਕਿ ਦੂਜੇ ਵਿੱਚ ਪੈਰਾਡੋਕਸ ਅਤੇ ਐਮ ਸੀ ਸਕੇਅਰ ਨੇ ਇਕੱਠੇ ਗਾਣਾ ਗਾਇਆ ਸੀ ਅਤੇ ਉਹ ਪਹਿਲੇ ਦੂਜੇ ਨੰਬਰ 'ਤੇ ਆ ਗਏ ਸੀ ਅਤੇ ਤੀਜੇ ਵਿੱਚ ਉਦੇ ਅਤੇ ਬੇਸਿਕ ਨੇ ਇਕੱਠੇ ਗਾਣਾ ਗਾਇਆ ਅਤੇ ਉਹ ਵੀ ਪਹਿਲੇ ਦੂਜੇ ਨੰਬਰ 'ਤੇ ਆ ਗਏ ਨੇ ਇਹ ਬਹੁਤ ਜ਼ਿਆਦਾ ਮੈਨੂੰ ਪ੍ਰਭਾਵਿਤ ਕਰਦਾ ਹੈ ਸ਼ੋ ਮੈਂ ਜਦੋਂ ਵੀ ਇਹਨੂੰ ਵੇਖਦਾ ਹਾਂ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਗਾਇਕ ਬਣਾ ਅਤੇ ਗਾਣੇ ਗਾਵਾਂ ਇਹਨਾਂ ਦੇ ਗਾਣੇ ਸੁਣ ਸੁਣ ਕੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ ਅਤੇ ਨਵੇਂ ਗਾਇਕਾਂ ਨੂੰ ਇਹੀ ਮੋਟੀਵੇਸ਼ਨ ਬਹੁਤ ਦਿੰਦੇ ਨੇ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੇ ਨੇ ਜਿਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਉਹ ਪ੍ਰਭਾਵਿਤ ਹੁੰਦੇ ਨੇ ਅਤੇ ਆਪਣੇ ਆਪਣੇ ਗਾਣੇ ਲਿਖ ਸਕਦੇ ਨੇ ਦੋ ਹਜ਼ਾਰ ਉੱਨੀ ਤੋਂ ਪਹਿਲਾਂ ਕੋਈ ਲੋਕ ਆਪਣਾ ਗਾਣਾ ਨਹੀਂ ਲਿਖਦੇ ਸੀ ਪਰ ਹੁਣ ਦੇਖਿਆ ਜਾਵੇ ਤਾਂ ਅੱਧ ਅੱਧੀ ਆਬਾਦੀ ਭਾਰਤ ਦੇਸ਼ ਦੀ ਗਾਣੇ ਲਿਖਣ ਲੱਗ ਪਈ ਹੈ ਆਪਣੇ ਆਪੇ ਇਹ ਬਹੁਤ ਜ਼ਿਆਦਾ ਵਧੀਆ ਗੱਲ ਹੈ ਇਸ ਕਰਕੇ ਬੰਦਿਆਂ ਨੂੰ ਰੁਜ਼ਗਾਰ ਵੀ ਕਾਫੀ ਮਿਲਦਾ ਹੈ ਆਪਣੇ ਆਪਣੇ ਗਾਣੇ ਬਣਾ ਕੇ ਤੁਸੀਂ ਇੰਟਰਨੈਟ ਜਾਂ ਯੂਟੀਊਬ ਵਗੈਰਾ 'ਤੇ ਪਾ ਸਕਦੇ ਹੋ ਜਿਸ ਦਾ ਫਿਰ ਯੂਟੀਊਬ ਵਾਲੇ ਤੁਹਾਨੂੰ ਪੈਸਾ ਦੇਣਗੇ ਤੁਸੀਂ ਘਰ ਬੈਠੇ ਹੀ ਪੈਸਾ ਕਮਾ ਸਕਦੇ ਹੋ ਇਹ ਹੋਰ ਵੀ ਜ਼ਿਆਦਾ ਬਹੁਤ ਹੀ ਕਿ ਗਾਣੇ ਸੁਣਨ ਨਾਲ ਤੁਹਾਡਾ ਦਿਮਾਗ ਵੀ ਇੱਕਦਮ ਠੰਡਾ ਰਹਿੰਦਾ ਹੈ ਤੁਹਾਨੂੰ ਗੁੱਸਾ ਨਹੀਂ ਆਉਂਦਾ ਜੇ ਕਿਸੇ ਨੂੰ ਗੁੱਸਾ ਆਉਂਦਾ ਹੈ ਉਹ ਗਾਣਾ ਸੁਣ ਕੇ ਜਾਂ ਸ਼ੋ ਦੇਖ ਕੇ ਆਪਣਾ ਗੁੱਸਾ ਵੀ ਠੰਡਾ ਕਰ ਸਕਦਾ ਹੈ